ਮੈਂ ਤੁਹਾਨੂੰ ਆਪਣੇ ਪਿੰਡ ਵਿੱਚ ਹੁੰਦੀਆਂ ਅੰਤਿਮ ਸੰਸਕਾਰ ਰਸਮਾਂ ਬਾਰੇ ਕੁਛ ਜਾਣਕਾਰੀ ਦੇਵਾਂਗੀ ਅਤੇ ਉਸ ਵਿੱਚ ਪਹਿਲਾਂ ਜਦੋਂ ਕਿਸੇ ਡੈੱਥ ਹੁੰਦੀ ਆ ਤਾਂ ਪਹਿਲਾਂ ਜਿਹੜੀਆਂ ਤੀਵੀਆਂ ਨੇ ਪਿੰਡ ਦੀਆਂ ਇਕੱਠੀਆਂ ਹੋ ਕੇ ਉਹ ਵੈਣ ਪਾਉਂਦੀਆਂ ਨੇ ਅਤੇ ਉਸ ਤੋਂ ਬਾਅਦ ਜਿਹੜੇ ਕਿ ਉਹਦੇ ਉਹਨਾਂ ਦੇ ਪੇਕੇ ਜਾਂ ਨਾਨਕੇ ਹੁੰਦੇ ਨੇ ਤਾਂ ਉਹ ਲੈ ਕੇ ਆਉਂਦੇ ਨੇ ਸੂਟ ਲੈ ਕੇ ਆਉਂਦੇ ਨੇ ਸਮਾਨ ਲੈ ਕੇ ਆਉਂਦੇ ਨੇ ਨਹਾਉਣ ਵਾਸਤੇ ਅਤੇ ਉਸ ਤੋਂ ਬਾਅਦ ਉਸਦੀ ਨਵਾਈ ਧੋਈ ਹੁੰਦੀ ਹੈ ਨਵਾਉਣ ਤੋਂ ਬਾਅਦ ਉਸਨੂੰ ਤਿਆਰ ਕੀਤਾ ਜਾਂਦਾ ਹੈ ਤਿਆਰ ਕਰਨ ਤੋਂ ਬਾਅਦ ਉਹਨੂੰ ਅਰਥੀ 'ਤੇ ਪਾਇਆ ਜਾਂਦਾ ਅਰਥੀ ਤੋਂ ਬਾਅਦ ਪਾਉਣ ਤੋਂ ਬਾਅਦ ਮੱਥਾ ਟੇਕਿਆ ਜਾਂਦਾ ਸਾਰਿਆਂ ਵੱਲੋਂ ਸਰੀਕੇ ਵੱਲੋਂ ਅਤੇ ਜਿਹੜੇ ਰਿਸ਼ਤੇਦਾਰ ਆਏ ਹੁੰਦੇ ਆ ਉਹਨਾਂ ਵੱਲੋਂ ਅਤੇ ਉਸ ਤੋਂ ਬਾਅਦ ਅਰਥੀ ਚੁੱਕੀ ਜਾਂਦੀ ਹੈ ਅਤੇ ਅਰਥੀ ਚਾਰ ਜਣੇ ਚੁੱਕਦੇ ਨੇ ਜਿਵੇਂ ਉਸਦੇ ਮੁੰਡੇ ਹੋ ਗਏ ਉਹ ਚੁੱਕਦੇ ਨੇ ਅਤੇ ਉਸ ਤੋਂ ਬਾਅਦ ਅਰਥੀ ਲੈ ਕੇ ਜਾਂਦੇ ਨੇ ਅਤੇ ਜਦੋਂ ਅਰਥੀ ਸੀਵਿਆਂ 'ਚ ਲੈ ਜਾਂਦੇ ਨੇ ਫਿਰ ਉੱਥੇ ਉਹ ਪਾਠੀ ਵੱਲੋਂ ਅਰਦਾਸ ਕੀਤੀ ਜਾਂਦੀ ਆ ਅੰਤਿਮ ਰਸਮਾਂ ਕੀਤੀਆਂ ਜਾਂਦੀਆਂ ਨੇ ਉੱਥੇ ਅਤੇ ਦੇਸੀ ਘੀ ਪਾਏ ਜਾਂਦੇ ਅਤੇ ਚੰਦਨ ਦੀ ਲੱਕੜੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਉਸਨੂੰ ਅੰਤਿਮ ਅੱਗ ਲਗਾ ਦਿੱਤੀ ਜਾਂਦੀ ਹੈ ਅੱਗ ਲਗਾਉਣ ਤੋਂ ਬਾਅਦ ਉੱਥੇ ਅਰਦਾਸ ਹੁੰਦੀ ਆ ਅਰਦਾਸ ਕਰਨ ਤੋਂ ਬਾਅਦ ਉਹ ਗੁਰਦੁਆਰੇ 'ਚ ਆ ਜਾਂਦੇ ਨੇ ਗੁਰਦੁਆਰੇ ਆਉਣ ਤੋਂ ਬਾਅਦ ਹੁਕਮਨਾਮਾ ਪੜ੍ਹਿਆ ਜਾਂਦਾ ਹੁਕਮਨਾਮਾ ਪੜ੍ਹਨ ਤੋਂ ਬਾਅਦ ਉੱਥੇ ਰੋਟੀ ਵਗੈਰਾ ਦਾ ਜੋ ਹੁੰਦਾ ਸਿਸਟਮ ਸਾਦਾ ਉਹ ਕਰ ਦਿੰਦੇ ਨੇ